ਹਸਪਤਾਲ ਦਾ ਦ੍ਰਿਸ਼ ਬਾਹਰ ਤੋਂ ਦੇਖਣ ਨੂੰ ਚੰਗਾ ਲੱਗਦਾ ਹੈ ਪਰ ਜਦੋਂ ਅਸੀਂ ਹਸਪਤਾਲ ਦੇ ਅੰਦਰ ਜਾ ਕੇ ਉਸਦਾ ਅਸਲੀ ਦ੍ਰਿਸ਼ ਦੇਖਦੇ ਹਾਂ ਤਾਂ ਸਾਨੂੰ ਉਸਦੀ ਅਸਲੀਅਤ ਬਾਰੇ ਪਤਾ ਚੱਲਦਾ ਹੈ ਬਲਕਿ ਜਦੋਂ ਵੀ ਅਸੀਂ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਦੇਖਦੇ ਹਾਂ ਤਾਂ ਉਹਨਾਂ ਵਿੱਚ ਮਰੀਜ਼ ਨੂੰ ਉਦੋਂ ਤੱਕ ਦਾਖਲ ਨਹੀਂ ਕੀਤਾ ਜਾਂਦਾ ਜਦੋਂ ਤੱਕ ਕਿ ਉਹ ਆਪਣੇ ਫਾਰਮ ਅਤੇ ਆਪਣੀ ਫੀਸ ਬ ਭਰ ਨਾ ਦੇਵੇ ਜਦੋਂ ਭਾਵੇਂ ਮਰੀਜ਼ ਜਿੰਨਾ ਵੀ ਮਰਜ਼ੀ ਐਮਰਜੈਂਸੀ ਵਿੱਚ ਹੋਵੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ ਨੂੰ ਤਿੰਨ ਜਾਂ ਚਾਰ ਦਿਨ ਤੱਕ ਵੈਂਟੀਲੇਟਰ ਉੱਪਰ ਪਾ ਕੇ ਰੱਖਿਆ ਜਾਂਦਾ ਹੈ ਭਾਵੇਂ ਉਹ ਮਰ ਹੀ ਕਿਉਂ ਨਾ ਗਿਆ ਹੋਵੇ

ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਉਪਲੱਬਧ ਕਰਵਾਉਣ ਜਿਸ ਨਾਲ ਗਰੀਬ ਲੋਕਾਂ ਨੂੰ ਆਸਾਨੀ ਹੋ ਸਕੇ ਅਤੇ ਉਹ ਆਪਣਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਘੱਟ ਖਰਚੇ ਵਿੱਚ ਕਰਵਾ ਸਕਣ ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਓਹ ਖਰ ਉਹਨਾਂ ਕੋਲ ਖਰਚਾ ਕਰਨ ਲਈ ਪੈਸੇ ਨਹੀਂ ਹੁੰਦੇ ਅਤੇ ਗਰੀਬ ਲੋਕਸ ਲੋਕ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ ਹਸਪਤਾਲਾਂ ਵਿੱਚ ਤਾਂ ਸਟਾਫ਼ ਵੀ ਪੂਰਾ ਨਹੀਂ ਹੁੰਦਾ ਅਤੇ ਲੋਕ ਰਿਸੈਪਸ਼ਨ ਉੱਪਰ ਵੀ ਘੱਟ ਹੀ ਲੋਕ ਅਵੇਲੇਬਲ ਹੁੰਦੇ ਹਨ ਜਿਹੜੇ ਕਿ ਮਰੀਜ਼ ਨੂੰ ਸਾਂਭ ਸਕਣ ਧੰਨਵਾਦ